ਸਤਿ ਸ਼੍ਰੀ ਅਕਾਲ ਸਰ ਪਿੰਡਾਂ ਦੀ ਪਿੰਡਾਂ ਦੇ ਵਿੱਚ ਜਿਹੜੀਆਂ ਮੁਰਗੀਆਂ ਦਾ ਅਤੇ ਪੋਲਟਰੀ ਫਾਰਮ ਦੇ ਵਿੱਚ ਇਹਨਾਂ ਦ ਪਿੰਡਾਂ ਦੀਆਂ ਮੁਰਗੀਆਂ ਤੇ ਫਾਰਮ ਦੀਆਂ ਮੁਰਗੀਆਂ ਦੇ ਵਿੱਚ ਬਹੁਤ ਹੀ ਅੰਤਰ ਹੈ ਜਿਹੜੀਆਂ ਪਿੰਡਾਂ ਦੀਆਂ ਮੁਰਗੀਆਂ ਅਤੇ ਮੁਰਗੇ ਹੈ ਇਹਨਾਂ ਵਿੱਚ ਬਹੁਤ ਹੀ ਤਾਕਤ ਹੁੰਦੀ ਹੈ ਇਹਨਾਂ ਨੂੰ ਬਾਹਰ ਦਾ ਖੁੱਲ੍ਹਾ ਬਾਤਾ ਫਿਰਨ ਵਾਸਤੇ ਹੀ ਛੱਡਿਆ ਜਾਂਦਾ ਹੈ ਇਹਨਾਂ ਨੂੰ ਆਪਣੇ ਘਰ ਦਾ ਹੀ ਅੱਛਾ ਚੋਗਾ ਦਿੱਤਾ ਜਾਂਦਾ ਹੈ ਜਿਹੜਾ ਫਾਰਮ ਦੀਆਂ ਮੁਰਗੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਕਣਕ ਅਤੇ ਦ ਦਲੀਆ ਪੀਸ ਕੇ ਖਵਾਇਆ ਜਾਂਦਾ ਹੈ ਉਹਨਾਂ ਨੂੰ ਪਾਣੀ ਵੀ ਪਿਲਾਇਆ ਜਾਂਦਾ ਹੈ ਉਹਨਾਂ ਦੇ ਵਿੱਚ ਕੋਈ ਉਹ ਫਾਰਮੀ ਮੁਰਗੀ ਤਿਆਰ ਕੀਤੀ ਜਾਂਦੀ ਹੈ ਜਿਹੜੀ ਘਰਾਂ ਦੇ ਵਿੱਚ ਮੁਰਗੀ ਤਿਆਰ ਕੀਤੀ ਜਾਂਦੀ ਹੈ ਉਹ ਬਹੁਤ ਹੀ ਤਾਕਤਵਰ ਹੁੰਦੀ ਹੈ ਉਹਨਾਂ ਨੂੰ ਪਿੰਡਾਂ ਦੀਆਂ ਜਿਹੜੀਆਂ ਮੁਰਗੀਆਂ ਨੇ ਉਹਨਾਂ ਨੂੰ ਵੇਚਣ 'ਤੇ ਵੀ ਬਹੁਤ ਹੀ ਲਾਭਦਾਇਕ ਸਾਨੂੰ ਪੈਸਾ ਪ੍ਰਾਪਤ ਹੁੰਦਾ ਹੈ